ਸਤਿ ਸ਼੍ਰੀ ਅਕਾਲ ਸਰ ਮੇਰਾ ਨਾਮ ਆਰਤੀ ਮੈਂ ਪਠਾਨਕੋਟ ਤੋਂ ਬੋਲਦੀ ਪਈ ਹਾਂ ਮੈਂ ਖਾਣੇ ਬਾਰੇ ਦੱਸਣਾ ਚਾਹੁੰਦੀ ਹਾਂ ਕਿ ਔਰਤਾਂ ਨੂੰ ਖਾਣਾ ਬਣਾਉਣਾ ਬਹੁਤ ਜ਼ਰੂਰੀ ਹੈ ਸਿੱਖਣਾ ਚਾਹੀਦਾ ਸਭ ਕੁਛ ਮੈਂ ਆਪਣੇ ਘਰ ਸਾਰਾ ਖਾਣਾ ਬਣਾ ਸਕਦੀ ਹਾਂ ਜਿੱਦਾਂ ਕਿ ਰਾਜਮਾਹ ਮਟਰ ਪਨੀਰ ਚਾਵਲ ਮਿੱਠੇ ਚਾਵਲ ਮੇਰੇ ਬੱਚਿਆਂ ਨੂੰ ਬਹੁਤ ਪਸੰਦ ਹੈ ਮੈਂ ਮੇਰੀ ਫੈਮਿਲੀ ਸਭ ਕੁਛ ਖਾਣਾ ਬਣਾ ਸਕਦੇ ਆ ਜਿੱਦਾਂ ਮੇਰੇ ਜਿਸ ਤਰ੍ਹਾਂ ਕਿ ਬਾਹਰ ਜਾਣਾ ਹੋਏ ਮੇਰੀ ਫੈਮਿਲੀ ਆਪਣਾ ਖਾਣਾ ਖੁਦ ਬਣਾ ਸਕਦੀ ਹੈ ਔਰ ਹਸਬੈਂਡ ਨੂੰ ਵੀ ਖਾਣਾ ਬਣਾਉਣਾ ਜ਼ਰੂਰੀ ਹੈ ਕਿਉਂਕਿ ਮੇਰੇ ਹਸਬੈਂਡ ਬਾਏਰਮ ਬਾਹਰ ਰਹਿੰਦੇ ਹੈ ਉਹ ਆਪਣਾ ਖਾਣਾ ਉੱਥੇ ਖੁਦ ਬਣਾ ਸਕਦੇ ਹੈ ਪਹਿਲਾਂ ਤਾਂ ਉਨ੍ਹਾਂ ਨੂੰ ਖਾਣਾ ਬਣਾਉਣਾ ਨਹੀਂ ਸੀ ਆਉਂਦਾ ਅਤੇ ਮੈਂ ਉਨ੍ਹਾਂ ਨੂੰ ਸਭ ਕੁਛ ਸਿਖਾ ਦਿੱਤਾ ਕਿਉਂਕਿ ਮੇਰੀ ਮੰਮਾਂ ਨੇ ਮੈਨੂੰ ਸਭ ਕੁਛ ਸਿਖਾਇਆ ਹੈਗਾ ਖਾਣਾ ਬਣਾਉਣਾ ਇਸ ਕਰਕੇ ਮੇਰੇ ਹਸਬੈਂਡ ਸਭ ਕੁਛ ਆਪਣਾ ਖਾਣਾ ਹੁਣ ਖੁਦ ਬਣਾ ਸਕਦੇ ਹੈ ਕੋਈ ਵੀ ਰੈਸਪੀ ਵੀ ਬਣਾ ਸਕਦੇ ਹੈ ਜਿੱਦਾਂ ਕਿ ਨਿਊਡਲ ਮੋਮੋਸ ਮੈਗੀ ਸਭ ਕੁਛ ਆਪ ਬਣਾ ਸਕਦੇ ਹੈ ਕਿਉਂਕਿ ਖਾਣਾ ਬਣਾਉਣਾ ਜ਼ਰੂਰੀ ਹੈ ਮਰਦਾਂ ਨੂੰ ਵੀ ਔਰਤਾਂ ਨੂੰ ਵੀ ਸਭ ਕੁਛ ਆਉਣਾ ਚਾਹੀਦਾ ਹੈ